ਭਾਰਤ ਵਿੱਚ ਪੜ੍ਹੇ ਲਿਖੇ ਨੌਜਵਾਨ ਬਹੁਤ ਹਨ ਪਰ ਭਾਰਤ ਵਿੱਚ ਰੁਜ਼ਗਾਰ ਦੇ ਮੌਕੇ ਬਹੁਤ ਘੱਟ ਹਨ ਕਿਉਂਕਿ ਭਾਰਤ ਦੀਆਂ ਸਰਕਾਰਾਂ ਜਿਹੜੀਆਂ ਉਹ ਬਹੁਤਾ ਰੁਜ਼ਗਾਰ ਵੱਲ ਧਿਆਨ ਨਾ ਦੇ ਕੇ ਪੈਸੇ ਖਾਣ ਵੱਲ ਲੱਗੀਆਂ ਹੋਈਆਂ ਅਤੇ ਉਹਨਾਂ ਨੂੰ ਚਾਹੀਦਾ ਜ਼ਿਆਦਾਤਰ ਮਤਲਬ ਕਿ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਦਿੱਤੇ ਜਾਣ ਤਾਂ ਜੋ ਆਪਣੀ ਜ਼ਿੰਦਗੀ ਸਵਾਰ ਸਕਣ ਭਾਰਤ ਵਿੱਚ ਬਹੁਤ ਜ਼ਿਆਦਾ ਕੰਮ ਕਰਨ ਨੂੰ ਹੈਗਾ ਪਰ ਜਿਹੜੀਆਂ ਸਰਕਾਰਾਂ ਹੈ ਉਹ ਉਹਨਾਂ ਨੂੰ ਰੁਜ਼ਗਾਰ ਦੇ ਮੌਕੇ ਬਹੁਤਾ ਪ੍ਰਦਾਨ ਨਹੀਂ ਕਰਦੀਆਂ ਇਸ ਲਈ ਜਿਹੜੇ ਨੌਜਵਾਨ ਹੈ ਉਹ ਗਲਤ ਕੰਮਾਂ ਵੱਲ ਲੱਗ ਜਾਂਦੇ ਹੈ ਅਤੇ ਜਿਵੇਂ ਨਸ਼ਿਆਂ ਵੱਲ ਚਲੇ ਜਾਂਦੇ ਹੈ ਹੋਰ ਗਲਤ ਕੰਮ ਚੋਰੀਆਂ ਚਕਾਰੀਆਂ ਕਰਦੇ ਹੈ ਅਤੇ ਇਸ ਨਾਲ ਕੀ ਹੁੰਦਾ ਭਾਰਤ ਦਾ ਮਾਹੌਲ ਖਰਾਬ ਹੁੰਦਾ ਅਤੇ ਲੋਕੀਂ ਜ਼ਿਆਦਾਤਰ ਜੇ ਗਲਤ ਕੰਮ ਨਹੀਂ ਕਰਦੇ ਤਾਂ ਲੋਕੀਂ ਬਾਹਰ ਨੂੰ ਜਾਂਦੇ ਹੈ ਅਤੇ ਬਾਹਰ ਜਾਂਦੇ ਹੋਏ ਆਪਣਾ ਪੈਸਾ ਜਿਹੜਾ ਭਾਰਤ ਦਾ ਹੈਗਾ ਉਹ ਵੀ ਬਾਹਰ ਲੈ ਜਾਂਦੇ ਹੈ ਜਿਸ ਨਾਲ ਭਾਰਤ ਦੀ ਤਰੱਕੀ ਰੁਕਦੀ ਹੈ ਅਤੇ ਆਪਣਾ ਭਾਰਤ ਦਾ ਪੈਸਾ ਜਿਹੜਾ ਉਹ ਬਾਹਰਲੀਆਂ ਕੰਟਰੀਆਂ 'ਚ ਬਾਹਰਲੀਆਂ ਵਿਦੇਸ਼ਾਂ ਵਿੱਚ ਚਲੇ ਚਲੇ ਜਾਂਦਾ ਅਤੇ ਉਹ ਸਾਰੇ ਬਾਹਰ ਜਾ ਕੇ ਉਸ ਪੈਸੇ ਨੂੰ ਉਸ ਸਿਟੀ ਵਿੱਚ ਜਾ ਕੇ ਯੂਜ਼ ਕਰਦੇ ਹਾਂ ਜਿਸ ਨਾਲ ਭਾਰਤ ਦਾ ਨੁਕਸਾਨ ਹੁੰਦਾ ਅਤੇ ਇਸ ਨਾਲ ਸਾਡੇ ਸਾਡੀ ਜਿਹੜੀ ਅਰਥ ਵਿਵਸਥਾ ਉਹ ਬਹੁਤ ਜ਼ਿਆਦਾ ਕਮਜ਼ੋਰ ਹੋ ਜਾਂਦੀ ਹੈ